ਹੈਲੋ ਹਾਂਜੀ ਭਾਅ ਜੀ ਗੈਸ ਏਜੰਸੀ ਤੋਂ ਬੋਲਦੇ ਹੋ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਯਾਰ ਤੁਸੀਂ ਮੈਂ ਪਰਸੋਂ ਸਲੰਡਰ ਬੁੱਕ ਕਰਵਾਇਆ ਸੀਗਾ ਯਾਰ ਤੁਸੀਂ ਚੈੱਕ ਕਰਿਓ ਆਈ ਡੀ ਨੰਬਰ ਹੋਣੀ ਆ ਪੰਜ ਫੋਰ ਛੇ ਦੇਖਿਓ ਅਸ਼ੀਸ਼ ਦੇ ਨਾਮ ਤੋਂ ਹੋਣਾ ਭਾਅ ਜੀ ਅਤੇ ਨਾਲੇ ਯਾਰ ਮੈਂ ਪਰਸੋਂ ਬੁੱਕ ਕਰਵਾਇਆ ਸੀ ਪੈਸੇ ਪੂਸੇ ਵੀ ਸਾਰੇ ਪੂਰੇ ਦਿੱਤੇ ਆ ਪਰ ਵੈਸੇ ਤਾਂ ਤੁਸੀਂ ਮੰਨਦੇ ਹੋ ਕਿ ਵੀਹ ਕਿਲੋ ਦਾ ਹੁੰਦਾ ਵਾ ਹੈ ਨਾ ਕੇਜੀ ਸੋਰੀ ਕੇਜੀ ਦਾ ਹੁੰਦਾ ਵਾ ਪਰ ਆ ਮੈਨੂੰ ਨਾ ਸੋਲਾਂ ਕ ਕੇਜੀ ਦਾ ਆਇਆ ਵਾ ਉਹ ਸਲੰਡਰ ਇਹਦਾ ਵਜ਼ਨ ਕਿਉਂ ਘੱਟ ਆ ਯਾਰ ਕਿਉਂਕਿ ਕਿਉਂਕਿ ਨਾ ਹਾਂ ਹਾਂ ਮੈਂ ਨਾ ਐਕਚੁਲੀ ਸੀਲ ਵੀ ਨਹੀਂ ਖੋਲ੍ਹੀ ਹੈਗੀ ਯਾਰ ਮੈਂ ਸਹੀ ਗੱਲ ਦੱਸ ਤੁਹਾਨੂੰ ਦੱਸਾਂ ਸੱਚੀ ਗੱਲ ਦੱਸਦਾ ਯਾਰ ਸੀਲ ਵੀ ਨਹੀਂ ਖੋਲ੍ਹੀ ਤੁਸੀਂ ਮੈਨੂੰ ਉਹ ਸਿੱਧਾ ਚਾਰ ਕਿਲੋ ਤੁਸੀਂ ਮੰਨਦੇ ਹੋ ਨਾ ਯਾਰ ਦੇਖੋ ਡਿਲੀਵਰੀ ਹੋਈ ਸੀ ਅਤੇ ਇੱਧਰ ਡਿਲੀਵਰੀ ਵਾਲੇ ਵੈਸੇ ਤਾਂ ਘੁੰਮਦੇ ਫਿਰਦੇ ਰਹਿੰਦੇ ਕਿ ਹੁਣ ਮੈਂ ਕੰਮ ਕਾਜੀ ਬੰਦਾ ਨਹੀਂ ਨਹੀਂ ਮੈਂ ਉਹੀ ਕਹਿ ਰਿਹਾ ਨਾ ਮੈਂ ਕੰਮ ਕਾਜੀ ਬੰਦਾ ਯਾਰ ਮੈਂ ਥੋੜ੍ਹਾ ਨਾ ਬਿਜ਼ੀ ਰਹਿੰਦਾ ਹਾਂ ਤੁਸੀਂ ਕਿਸੇ ਡਿਲੀਵਰੀ ਬੋਆਏ ਨੂੰ ਜੇਕਰ ਕਹਿ ਸਕਦੇ ਹੋ ਤਾਂ ਕਹਿ ਦੋਗੇ ਅੰਮ੍ਰਿਤਸਰ ਦੇ ਚਲੋ ਠੀਕ ਆ ਫਿਰ ਦੇਖਦਾ ਕਿਉਂਕਿ ਮੈਂ ਹੁਣ ਕਿਉਂਕਿ ਮੈਨੂੰ ਹ ਡੇਢ ਕੁ ਦਿਨ ਲੱਗ ਜਾਣਾ ਹਜੇ ਕਿਉਂਕਿ ਨਾ ਮੇਰਾ ਥੋੜ੍ਹਾ ਅਰਜੈਂਟ ਕੰਮ ਵੀ ਆ ਠੀਕ ਆ ਮੈਂ ਡੇਢ ਦਿਨ ਬਾਅਦ ਨਾ ਆਉਂਦਾ ਏਜੰਸੀ 'ਚ ਤੁਸੀਂ ਮਿਲੋਂਗੇ ਨਾ ਠੀਕ ਆ ਭਾਅ ਜੀ ਧੰਨਵਾਦ